ਮੈਂ ਜ਼ਿਆਦਾਤਰ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੀ ਹਾਂ ਪਰ ਕਦੀ ਕਦੀ ਸੋਸ਼ਲ ਮੀਡੀਆ ਪ੍ਰਸਾਰਿਤ ਵਟਸਐਪ ਦੀ ਵਰਤੋਂ ਕਰਦੀ ਹਾਂ ਇਸਦੇ ਦੁਆਰਾ ਮੈਂ ਕੋਈ ਨਵੀਂ ਵੀਡੀਓ ਜਾਂ ਸੁਨੇਹਾ ਆਸਾਨੀ ਨਾਲ ਭੇਜ ਸਕਦੀ ਹਾਂ ਇਹ ਇਸਦਾ ਇੱਕ ਬਹੁਤ ਵੱਡਾ ਫਾਇਦਾ ਹੈ ਪਰ ਅੱਜ ਦੇ ਸਮੇਂ ਵਿੱਚ ਲੋਕ ਪੂਰੀ ਤਰ੍ਹਾਂ ਇਨ੍ਹਾਂ ਐਪਾਂ ਦੀ ਵਰਤੋਂ ਕਰਕੇ ਇਹਨਾਂ ਉੱਤੇ ਨਿਰਭਰ ਹੋ ਗਏ ਹਨ ਜੋ ਕਿ ਮੈਨੂੰ ਬਿਲਕੁਲ ਠੀਕ ਨਹੀਂ ਲੱਗਦਾ ਪਹਿਲੇ ਸਮੇਂ ਵਿੱਚ ਇਹਾ ਚੀਜ਼ਾਂ ਨਹੀਂ ਸੀ ਦਾ ਸਾਧਨ ਚਿੱਠੀਆਂ ਜਾਂ ਟੈਲੀਫੋਨ ਸਨ ਕਿਸੇ ਕਿਸੇ ਘਰ ਵਿੱਚ ਸੀ ਪਰ ਅੱਜ ਦੇ ਸਮੇਂ ਵਿੱਚ ਇੱਕ ਇਸ ਸੰਚਾਰ ਦੇ ਸਾਧਨ ਲਈ ਹੋ ਗਏ ਹਨ ਕਿ ਇਹਨਾਂ ਦੀ ਲੋਕਾਂ ਦਾ ਜੀਵਨ ਸੁਖਾਵਾਂ ਵੀ ਬਣਾਇਆ ਹੈ